ਹਾਂਜੀ ਅਸੀਂ ਸੈਲਾਨੀਆਂ ਨਾਲ ਬਹੁਤ ਵਾਰ ਗੱਲਬਾਤ ਕੀਤੀ ਆ ਅਤੇ ਸਾਡੇ ਦੂਰ ਦੇ ਰਿਸ਼ਤੇਦਾਰ ਵੀ ਆ ਜੋ ਹਿਮਾਚਲ 'ਚ ਰਹਿੰਦੇ ਆ ਅਤੇ ਉਹਨਾਂ ਨਾਲ ਅਸੀਂ ਬਹੁਤ ਜਾਣਕਾਰੀ ਉਹਨਾਂ ਸਾਨੂੰ ਸਾਨੂੰ ਦਿੱਤੀ ਅਸੀਂ ਵੀ ਅਗਾਂਹ ਸਾਂਝੀ ਕਰਦੀ ਉਹ ਵਾਲੀ ਜਾਣਕਾਰੀ ਅਤੇ ਉਹ ਵਧੀਆ ਸਾਨੂੰ ਉਹਨਾਂ ਨਾਲ ਗੱਲਬਾਤ ਕਰਕੇ ਵਧੀਆ ਲੱਗਾ ਉਹਨਾਂ ਦਾ ਵੀ ਸੁਭਾਅ ਬਹੁਤ ਵਧੀਆ ਸੀ ਉਹਨਾਂ ਨੂੰ ਸਾਡੀ ਇੱਥੋਂ ਦੀ ਹਰ ਇੱਕ ਚੀਜ਼ ਬੜੀ ਪਸੰਦ ਆਉਂਦੀ ਸੀ ਜਿਵੇਂ ਸਾਨੂੰ ਆਪਣੇ ਕਲਚਰ ਬਾਰੇ ਬਹੁਤ ਕੁਝ ਸਿਖਾ ਕੇ ਗਏ ਸਾਡਾ ਸਿੱਖ ਕੇ ਗਏ ਆ ਅਤੇ ਸਾਨੂੰ ਆਪਣੇ ਉੱਧਰ ਦੇ ਖਾਣੇ ਹਰ ਇੱਕ ਚੀਜ਼ ਜਿਵੇਂ ਉਹ ਜਿੱਥੇ ਜਿੱਥੇ ਜਾਂਦੇ ਜਿਹੜੀ ਜਿਹੜੀ ਜਗ੍ਹਾ 'ਤੇ ਵੀ ਘੁੰਮਦੇ ਫਿਰਦੇ ਸੀ ਉਹਨਾਂ ਨੂੰ ਸਾਡੇ ਇੱਧਰ ਦੇ ਸਥਾਨ ਜਿਹੜੇ ਜਿਵੇਂ ਕਿ ਗੁਰਦੁਆਰਾ ਅਤੇ ਵੀ ਗੁਰਦੁਆਰੇ ਬਹੁਤ ਪਸੰਦ ਆਉਂਦੇ ਸੀ ਜੀ ਉੱਧਰ ਇਵੇਂ ਚੀਜ਼ਾਂ ਨਹੀਂ ਹੁੰਦੀਆਂ ਹੁੰਦੇ ਆ ਗੁਰਦੁਆਰੇ ਬਹੁਤ ਹੋਰ ਹਿਸਾਬ ਦੇ ਹੁੰਦੇ ਆ ਸਾਡੇ ਇੱਧਰ ਥੋੜ੍ਹੇ ਵੀ ਜ ਵਧੀਆ ਕੀਤੇ ਹੈ ਜਿਵੇਂ ਦਰਬਾਰ ਸਾਹਿਬ ਵਾ ਹਰਿਮੰਦਰ ਸਾਹਿਬ ਵੇਖ ਕੇ ਗਏ ਉਹਨਾਂ ਨੂੰ ਸਾਡੇ ਘਰ ਬਹੁਤ ਵਧੀਆ ਲੱਗਾ ਸਾਡੇ ਖੇਤ ਪੈਲੀਆਂ ਇਹ ਚੀਜ਼ਾਂ ਬਹੁਤ ਪਸੰਦ ਆਈਆਂ ਇੱਥੋਂ ਦੇ ਰਹਿਣ ਸਹਿਣ ਸਾਡਾ ਸਾਗ ਸਰ੍ਹੋਂ ਦਾ ਹਰ ਇੱਕ ਚੀਜ਼ ਇੰਨੀ ਵਧੀਆ ਲੱਗਦੀ ਸੀ ਕਿ ਉਹ ਤਾਂ ਬਹੁਤ ਖੁਸ਼ ਹੋ ਗਏ ਉਹਨਾਂ ਦਾ ਜਾਣ ਦਾ ਮਨ ਨਹੀਂ ਸੀ ਕਰਦਾ ਪਿਆ ਅਤੇ ਹਰ ਇੱਕ ਚੀਜ਼ ਉਹਨਾਂ ਨੂੰ ਇੰਨੀ ਪਸੰਦ ਸੀ ਸਾਡਾ ਬੋਲੀ ਸਾਡਾ ਗਿੱਧਾ ਭੰਗੜਾ ਸਾਡੀ ਹਰ ਇੱਕ ਸੀ ਚੀਜ਼ ਸਾਡਾ ਪਿੰਡ ਥਾਂ ਜਿੱਦਾਂ ਖੁੱਲ੍ਹਾ ਘਰ ਸਾਡਾ ਸਾਡਾ ਉਹਨਾਂ ਨੂੰ ਇਹ ਸਥਾਨ ਬਹੁਤ ਪਸੰਦ ਆਇਆ